ਸਾਡੇ ਸ਼ਹਿਰਾਂ ਵਿੱਚ ਬਾਲ ਮਜ਼ਦੂਰੀ ਦੇ ਮੁੱਦੇ ਬਹੁਤ ਹੀ ਗੰਭੀਰ ਹਨ ਮੈਂ ਇਸ ਵਿੱਚ ਆਪਣੀ ਇਹ ਰਾਏ ਦੇਣਾ ਚਾਹੁੰਦੀ ਹਾਂ ਕਿ ਜਿਹੜੇ ਬੱਚਿਆਂ ਦੇ ਮਾਪਿਆਂ ਦੀ ਡੈਥ ਹੋ ਜਾਂਦੀ ਹੈ ਜਾਂ ਪਿਤਾ ਦੀ ਡੈਥ ਹੋ ਜਾਂਦੀ ਹੈ ਉਹ ਮਾਵਾਂ ਆਪਣੇ ਬੱਚਿਆਂ ਨੂੰ ਬਾਲ ਮਜ਼ਦੂਰੀ ਕਰਨ ਲਈ ਮਜ਼ਬੂਰ ਹੋ ਜਾਂਦੀਆਂ ਹਨ ਉਹ ਆਪਣੇ ਬੱਚਿਆਂ ਨੂੰ ਥਾਂ ਥਾਂ 'ਤੇ ਜਿਵੇਂ ਕਿ ਰੈਸਟੋਰੈਂਟ ਜਾਂ ਕਿਸੇ ਹੋਟਲ ਜਾਂ ਕਿਸੇ ਫੈਕਟਰੀ ਵਿੱਚ ਲਗਵਾ ਦਿੰਦੀਆਂ ਹਨ ਜਿੱਥੇ ਉਹ ਛੋਟੇ ਛੋਟੇ ਬੱਚੇ ਆਪਣਾ ਢਿੱਡ ਪਾਲਣ ਲਈ ਅਪ ਖਾਣ ਪੀਣ ਲਈ ਕੰਮ ਕਰਦੇ ਹਨ ਅਤੇ ਆਪਣਾ ਪਰਿਵਾਰ ਨੂੰ ਪਾਲਦੇ ਹਨ ਮੈਂ ਇਸ ਵਿੱਚ ਆਪਣੀ ਇਹ ਰਾਏ ਦੇਣਾ ਚਾਹੁੰਦੀ ਹਾਂ ਕਿ ਸਰਕਾਰ ਨੂੰ ਚਾਹੀਦਾ ਹੈ ਕਿ ਇਹਨਾਂ ਬੱਚਿਆਂ ਇਹਨਾਂ ਬੱਚਿਆਂ ਦੀ ਮਦਦ ਕਰਨ ਅਤੇ ਇਹਨਾਂ ਵਾਸਤੇ ਫਰੀ ਸਕੂਲ ਖੋਲੇ ਜਾਣ ਅਤੇ ਇਹਨਾਂ ਦੀ ਮਦਦ ਕੀਤੀ ਜਾਵੇ ਤਾਂ ਕਿ ਇਹ ਬੱਚੇ ਵੀ ਪੜ੍ਹ ਲਿਖ ਕੇ ਆਪਣੇ ਪੈਰਾਂ ਸਿਰ ਖੜੇ ਹੋ ਜਾਣ ਜਿਹੜੇ ਇਹ ਬੱਚੇ ਤਾਂ ਕਰਕੇ ਇਹਨਾਂ ਵੱਲ ਇਹਨਾਂ ਨੌਕਰੀਆਂ ਵੱਲ ਖਿੱਚੇ ਜਾਂਦੇ ਹਨ ਕਿਉਂਕਿ ਉਹਨਾਂ ਦੇ ਪਰਿਵਾਰ ਵਿੱਚ ਉਹਨਾਂ ਦੇ ਪਾਲਣ ਪੋਸ਼ਣ ਲਈ ਕੋਈ ਵੱਡਾ ਵਿਅਕਤੀ ਨਹੀਂ ਹੁੰਦਾ ਤਾਂ ਕਰਕੇ ਉਹ ਇਸ ਚੱਕਰਾਂ ਵਿੱਚ ਪੈ ਜਾਂਦੇ ਹਨ ਉਹ ਕਈ ਤਰ੍ਹਾਂ ਦੀਆਂ ਮਜ਼ਦੂਰੀਆਂ ਕਰਦੇ ਹਨ ਜਿਵੇਂ ਕਿ ਕਿਸੇ ਦੁਕਾਨ 'ਤੇ ਕਰਿਆਨੇ ਵਾਲੀ ਦੁਕਾਨ 'ਤੇ ਕੰਮ ਕਰਦੇ ਹਨ ਮੋਟਰ ਸਾਈਕਲ ਆਦਿ ਵਾਲੀ ਦੁਕਾਨ 'ਤੇ ਕੰਮ ਕਰਦੇ ਹਨ